ਮੁਰਗਿਆਂ ਨੂੰ ਸਿਹਤਮੰਦ ਰੱਖਣ ਵਾਸਤੇ ਸਾਨੂੰ ਉਹਨਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਜਿਵੇਂ ਉਹਨਾਂ ਨੂੰ ਪੋਲਟਰੀ ਫਰਮ ਦੇ ਵਿੱਚ ਮੁਰਗੀਆਂ ਨੂੰ ਸਾਫ਼ ਸੁਥਰੀ ਜਗ੍ਹਾ ਮਿਲਣੀ ਚਾਹੀਦੀ ਹੈ

ਅਤੇ ਸਮੇਂ ਸਮੇਂ ਦੇ ਨਾਲ ਉਹਨਾਂ ਨੂੰ ਜੋ ਆਪਾਂ ਚੰਗੀ ਖੁਰਾਕ ਦੇਵਾਂਗੇ ਤਾਂ ਉਹ ਆਪ ਵੀ ਸਿਹਤਮੰਦ ਰਹਿਣਗੀਆ ਅਤੇ ਜੋ ਬੰਦਾ ਉਹਨਾਂ ਨੂੰ ਲੈ ਕੇ ਜਾਂਦਾ ਖਾਣ ਪੀਣ ਵਾਲਾ ਹੈ ਨਾ ਉਹਨਾਂ ਦੀ ਵੀ ਸਿਹਤ ਦੇ ਵਿੱਚ ਸੁਧਾਰ ਹੀ ਆਉਂਦਾ ਹੈਗਾ ਅਤੇ ਸਾਨੂੰ ਮੁਰਗੀਆਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਦੀ ਸਾਫ਼ ਸਫਾਈ ਦਾ ਵੀ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੇ ਅਸੀਂ ਉਹਨਾਂ ਨੂੰ ਧਿਆਨ ਨਾਲ ਖੁਰਾਕ ਪਾਵਾਂਗੇ ਵਧੀਆ ਉਹਨਾਂ ਦੀ ਰਿਕਾਰਡਿੰਗ ਖੁਰਾਕ ਦੀ ਉਹਨਾਂ ਨੂੰ ਅਤੇ ਆਪ ਸਿਹਤਮੰਦ ਹੋਣਗੀਆਂ ਅਤੇ ਸਾਫ਼ ਸਫਾਈ ਦਾ ਧਿਆਨ ਰੱਖੀਏ ਪਾਣੀ ਦਾ ਧਿਆਨ ਰੱਖੀਏ ਟੈਂਮਪਰੇਚਰ ਉਹਨਾਂ ਦਾ ਵਾਰ ਵਾਰ ਦੇਖੀਏ ਹੈ ਨਾ ਜਿੱਦਾਂ ਦਾ ਵੀ ਉਹਨਾਂ ਨੂੰ ਚਾਹੀਦਾ ਸਾਨੂੰ ਉਹਨਾਂ ਨੂੰ ਮੁਰਗਿਆਂ ਨੂੰ ਪ੍ਰੋਪਰ ਖੁਰਾਕ ਦੇਣੀ ਚਾਹੀਦੀ ਹੈ ਅਤੇ ਸਮੇਂ ਸਿਰ ਸਾਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਗਾ ਅਤੇ ਜੇ ਉਹਨਾਂ ਨੂੰ ਕਿਸੇ ਟੀਕੇ ਵਗੈਰਾ ਦੀ ਲੋੜ ਹੈ ਤਾਂ ਸਾਨੂੰ ਉਹ ਵੀ ਉਹਨਾਂ ਦਾ ਦੇਖਣਾ ਚਾਹੀਦਾ ਅਤੇ ਸਾਨੂੰ ਸਮੇਂ ਸਮੇਂ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਧੰਨਵਾਦ